ਹੈਲੋ ਉਬਰ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਇਹ ਮੈਂ ਕੈਬ ਬੁੱਕ ਕਰਵਾਈ ਸੀ ਹਾਂਜੀ ਅਸੀਂ ਜਾਣਾ ਸੀ ਅਨੰਦਪੁਰ ਸਾਹਿਬ ਪੂਰੀ ਫੈਮਲੀ ਨੇ ਅਤੇ ਇਹ ਤੁਹਾਡੀ ਕੈਬ ਬੁੱਕ ਕਰਵਾਈ ਅਤੇ ਸਵੇਰੇ ਅੱਠ ਵਜੇ ਉਹਨੇ ਆਉਣਾ ਸੀ ਅਤੇ ਡਰਾਈਵਰ ਤੁਹਾਡਾ ਅਜੇ ਤੱਕ ਪਹੁੰਚਿਆ ਨਹੀਂ ਅਤੇ ਮੈਂ ਇੱਥੇ ਸੁਲਤਾਨਵਿੰਡ ਰੋਡ ਮੇਰਾ ਘਰ ਹੈ ਜਸਪਾਲ ਕੌਰ ਹੈ ਮੇਰਾ ਨਾਮ ਹਾਂਜੀ ਅਤੇ ਤੁਹਾਡੇ ਡਰਾਈਵਰ ਦਾ ਨਾਮ ਹੈਗਾ ਉਹਨੇ ਮੈਨੂੰ ਦੱਸਿਆ ਸੀ ਮਨਦੀਪ ਸਿੰਘ ਹੈ ਕੈਬ ਨੰਬਰ ਵੀ ਦੱਸਿਆ ਸੀ ਕੈਬ ਦਾ ਨੰਬਰ ਹੈਗਾ ਫਾਈਵ ਨਾਈਨ ਸਿਕਸ ਟੂ ਅਤੇ ਉਹ ਸਰ ਪਹੁੰਚਿਆ ਹੀ ਨਹੀਂ ਸਾਢੇ ਅੱਠ ਹੋ ਚੁੱਕੇ ਹੈ ਅਸੀਂ ਸਾਰੇ ਹੀ ਫੈਮਿਲੀ ਤਿਆਰ ਖੜ੍ਹੇ ਹਾਂ ਪਰ ਉਹ ਫੋਨ ਵੀ ਬ ਫੋਨ ਬਹੁਤ ਵਾਰੀ ਕੀਤਾ ਸਰ ਫੋਨ ਉਹ ਚੁੱਕ ਹੀ ਨਹੀਂ ਰਿਹਾ ਬਿਲਕੁਲ ਵੀ ਹਾਂਜੀ ਨੋਟ ਰੀਚੇਬਲ ਆ ਰਿਹਾ ਅਤੇ ਬੜੀ ਮੁਸ਼ਕਲ ਹੋ ਰਹੀ ਹੈ ਸਾਨੂੰ ਜੇ ਲੇਟ ਹੋ ਗਏ ਇਸ ਤੋਂ ਤਾਂ ਮੌਸਮ ਵੀ ਤੁਹਾਨੂੰ ਪਤਾ ਹੈ ਖਰਾਬ ਹੈ ਅਤੇ ਲੇਟ ਹੋ ਜਾਣਾ ਰਾਤੀ ਅਸੀਂ ਹੋਰ ਕਿੰਨੀ ਕੁ ਦੇਰ ਵੇਟ ਕਰੀਏ ਤੁਸੀਂ ਇਹਦਾ ਕੋਈ ਹੱਲ ਕੱਢੋ ਉਹਨੂੰ ਤੁਸੀਂ ਕੋਲ ਕਰੋ ਅਤੇ ਉਹਨੂੰ ਸਾਡੀ ਉੱਥੇ ਸਟੋਪ 'ਤੇ ਪਹੁੰਚਾਉ ਫਟਾਫਟ ਹਾਂਜੀ ਨਹੀਂ ਤਾਂ ਅਸੀਂ ਸਰ ਅੱਧਾ ਕੁ ਘੰਟਾ ਵੱਧ ਤੋਂ ਵੱਧ ਵੇਟ ਕਰ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਫਿਰ ਅਸੀਂ ਆਪਣਾ ਕੋਈ ਹੋਰ ਅਰੇਂਜਮੈਂਟ ਕਰਕੇ ਚਲੇ ਜਾਵਾਂਗੇ ਅਤੇ ਤੁਸੀਂ ਸਾਡੀ ਪੇਮੈਂਟ ਜਿਹੜੀ ਹੈ ਉਹ ਵਾਪਸ ਕਰ ਦੇਣਾ ਠੀਕ ਹੈ ਜੀ ਥੈਂਕ ਯੂ ਸਰ